ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਤਾਂ ਮੰਨ ਤਾਂ ਕਰਕੇ ਮੈਨੂੰ ਪੰਜਾਬੀ ਗਾਇਕ ਅਤੇ ਪੰਜਾਬੀ ਗਾਣੇ ਬਹੁਤ ਪਸੰਦ ਹਨ ਮੇਰਾ ਫੇਵਰੇਟ ਗਾਇਕ ਗੁਰਨਾਮ ਭੁੱਲਰ ਹੈ ਅਤੇ ਸਾਡ ਆ ਕੁਝ ਦਿਨ ਪਹਿਲਾਂ ਸਾਡੇ ਰਿਸ਼ਤੇਦਾਰੀ ਵਿੱਚ ਵਿਆਹ ਸੀਗਾ ਜਦੋਂ ਮੈਨੂੰ ਪਤਾ ਲੱਗਿਆ ਕਿ ਉਨ੍ਹਾਂ ਨੇ ਗੁਰਨਾਮ ਭੁੱਲਰ ਨੂੰ ਵਿਆਹ 'ਤੇ ਸੱਦਿਆ ਹੈ ਤਾਂ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹੋ ਗਈ ਅਤੇ ਜਦੋਂ ਫਿਰ ਅਸੀਂ ਵਿਆਹ 'ਤੇ ਗਏ ਤਾਂ ਉੱਥੇ ਗੁਰਨਾਮ ਭੁੱਲਰ ਨੇ ਲਾਈਵ ਪਰਫੋਰਮੈਂਸ ਕੀਤੀ ਮੈਂ ਉਹਨਾਂ ਦੇ ਗਾਣਿਆਂ 'ਤੇ ਬਹੁਤ ਨੱਚੀ ਅਤੇ ਅਸੀਂ ਬਹੁਤ ਹੀ ਰੌਲਾ ਪਾਇਆ ਅਤੇ ਨੱਚੇ ਅਤੇ ਸਾਰੇ ਜਾਣੇ ਇਕੱਠੇ ਮਿਲ ਕੇ ਗੁਰਨਾਮ ਭੁੱਲਰ ਨਾਲ ਫੋਟੋਆਂ ਵੀ ਖਿਚਾਈਆਂ ਅਤੇ ਮੈਨੂੰ ਬਹੁਤ ਹੀ ਵਧੀਆ ਲੱਗਿਆ ਉਹਨਾਂ ਦੇ ਗਾਣੇ 'ਤੇ ਅ ਨੱਚਣਾ ਅਤੇ ਉਨ੍ਹਾਂ ਨੇ ਬਹੁਤ ਹੀ ਵਧੀਆ ਗਾਇਆ ਸੀ ਅਤੇ ਮੈਨੂੰ ਵਿਆਵਾਂ ਵਿੱਚ ਜਾ ਕੇ ਨੱਚਣਾ ਬਹੁਤ ਹੀ ਪਸੰਦ ਹੈ ਖਾਸ ਕਰਕੇ ਆਪਣੇ ਫੇਵਰੇਟ ਸਿੰਗਰ ਦੇ ਗਾਣਿਆਂ ਉੱਤੇ ਅਤੇ ਮੈਨੂੰ ਬਹੁਤ ਹੀ ਵਧੀਆ ਲੱਗਿਆ ਜਾ ਕੇ ਅਤੇ ਵਿਆਵਾਂ ਵਿੱਚ ਬਹੁਤ ਆਨੰਦ ਮਾਣਿਆ ਨਾ ਕਿ ਸਿਰਫ ਇਹ ਵਿਆਹ ਵਿੱਚ ਮੈਂ ਹਰੇਕ ਵਿਆਹ ਵਿੱਚ ਹੀ ਬਹੁਤ ਆਨੰਦ ਮਾਣਦੀ ਹਾਂ ਅਤੇ ਬਹੁਤ ਹੀ ਖੁਸ਼ ਹੁੰਦੀ ਹਾਂ